ਅਠਾਰਾਂ ਜੂਨ ਉੱਨੀ ਸੌ ਅਠਾਨਵੇਂ ਨੌਂ ਜੁਲਾਈ ਦੋ ਹਜ਼ਾਰ ਪੰਜ ਦੋ ਅਕਤੂਬਰ ਦੋ ਹਜ਼ਾਰ ਇੱਕ ਛੱਬੀ ਜਨਵਰੀ ਉੱਨੀ ਸੌ ਪੰਜਾਹ ਇੱਕੀ ਜਨਵਰੀ ਦੋ ਹਜ਼ਾਰ ਸੌਲਾਂ